ਮੈਂ ਆਪਣੇ ਅੱਖੀ ਦੇਖਿਆ ਕਿ ਪਿਛਲੇ ਸਾਲ ਸਾਡੇ ਇੱਥੇ ਝੋਨਾ ਲਗਾਉਣ ਲਈ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਇੱਥੇ ਆਏ ਸੀ ਜਿਹਨਾਂ ਨੂੰ ਪੰਜਾਬ ਦੇ ਵਿੱਚ ਬਈਆ ਨਾਲ ਸੰਬੋਧਨ ਕੀਤਾ ਜਾਂਦਾ ਹੈ ਪਰ ਇੱਕ ਦਿਨ ਉਹਨਾਂ ਵਿੱਚੋਂ ਇੱਕ ਮਜ਼ਦੂਰ ਨੇ ਬਹੁਤ ਸਾਰਾ ਨਸ਼ਾ ਕਰ ਲਿਆ ਅਤੇ ਨਸ਼ੇ ਦੌਰਾਨ ਉਸ ਦੀ ਲੜਾਈ ਇੱਕ ਸਰਦਾਰ ਨਾਲ ਹੋ ਗਈ ਉਸ ਨੇ ਨਸ਼ਾ ਕਰਕੇ ਆਪਣੇ ਵਿੱਚ ਪਈਆਂ ਹੋਈਆਂ ਭਾਵਨਾਵਾਂ ਦੇ ਕਾਰਨ ਬੜਾ ਉਲਟਾ ਸਿੱਧਾ ਬੋਲਿਆ ਅਤੇ ਉਹ ਪੰਜਾਬ ਦੇ ਵਿੱਚ ਆਉਣ ਦੇ ਬਾਵਜੂਦ ਵੀ ਕਿਉਂਕਿ ਉਸ ਨੇ ਨਸ਼ਾ ਕੀਤਾ ਸੀਗਾ ਅਤੇ ਉਹ ਹੋਸ਼ 'ਚ ਨਹੀਂ ਸੀ ਤਾਂ ਉਸ ਨੇ ਬੇਗਾਨੇ ਏਰੀਏ ਦੇ ਵਿੱਚ ਆ ਕੇ ਜਿੱਥੇ ਕਿ ਸਿੱਖ ਬਹੁਤ ਗਿਣਤੀ ਵਿੱਚ ਹਨ ਉੱਥੇ ਆ ਕੇ ਸਿੱਖ ਧਰਮ ਬਾਰੇ ਮਾੜਾ ਧ ਬੋਲਿਆ ਜਾਂ ਕੁਛ ਹੋਰ ਐਵੇਂ ਦੀਆਂ ਗਾਲਾਂ ਕੱਢੀਆਂ ਕਿ ਉਸ ਨੂੰ ਹੋਸ਼ ਨਹੀਂ ਰਹੀ ਅਤੇ ਉਸ ਦੀ ਸਿੱਖ ਸਰਦਾਰ ਨਾਲ ਲੜਾਈ ਹੋ ਗਈ ਅਤੇ ਸਿੱਖ ਸਰਦਾਰ ਵੱਲੋਂ ਉਸ ਨੂੰ ਕੁਟਾਪਾ ਚਾੜਿਆ ਗਿਆ ਕਿਉਂਕਿ ਇੱਥੇ ਸਿੱਖਾਂ ਦੀ ਗਿਣਤੀ ਸਰਦਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਅਤੇ ਉਹਨਾਂ ਨੂੰ ਕੰਮ ਤੋਂ ਵੀ ਹੱਥ ਧੋਣਾ ਪਿਆ ਅਤੇ ਉਹ ਅਗਲੇ ਦਿਨ ਹੀ ਉਹਨਾਂ ਨੂੰ ਕੰਮ ਛੱਡ ਕੇ ਵਾਪਸ ਜਾਣਾ ਪਿਆ ਇਸ ਦਾ ਨਤੀਜਾ ਇਹ ਨਿਕਲਿਆ ਕਿ ਅਸੀਂ ਜੇਕਰ ਕਿਸੇ ਹੋਰ ਸਥਾਨ 'ਤੇ ਜਾਂਦੇ ਹਾਂ ਜਿੱਥੇ ਕਿ ਦੂਸਰੇ ਭਾਈਚਾਰੇ ਦੇ ਲੋਕ ਜ਼ਿਆਦਾ ਹੋਣ ਉੱਥੇ ਸਾਨੂੰ ਉਹਨਾਂ ਦੇ ਭਾਈਚਾਰੇ ਮੁਤਾਬਿਕ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਉਸ ਭਾਈਚਾਰੇ ਦੇ ਅਨੁਸਾਰ ਹੀ ਉੱਥੇ ਜਾ ਕੇ ਜੀਵਨ ਬਸਰ ਕਰਨਾ ਚਾਹੀਦਾ ਜੇਕਰ ਅਸੀਂ ਆਪਣਾ ਕੰਮ ਕਰਨਾ ਹੈ ਆਪਣਾ ਰੁਜ਼ਗਾਰ ਕਰਨਾ ਹੈ ਤਾਂ ਸਾਨੂੰ ਉਸ ਭਾਈਚਾਰੇ ਦੇ ਅਕੋਰਡਿੰਗ ਜਿਹੜਾ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ